ਅੱਜ ਦੇ ਸਮੇਂ ਵਿੱਚ ਭਾਰਤ ਸਰਕਾਰ ਨੂੰ ਬਹੁਤ ਚੁਣੌਤੀਆਂ ਆ ਰਹੀਆਂ ਹਨ ਅਤੇ ਉਹ ਹੱਲ ਵੀ ਕਰ ਰਹੀ ਹੈ ਜਿਵੇਂ ਕਿ ਆਪਾਂ ਹੁਣ ਕੋਈ ਚੁਣੌਤੀਆਂ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਰਕਾਰ ਨੂੰ ਇਹ ਚੁਣੌਤੀਆਂ ਆਈਆਂ ਕਿ ਹਰ ਖੇਤਰ ਵਿੱਚ ਪੜ੍ਹਾਈ ਦਾ ਮਾਧਿਅਮ ਘੱਟਦਾ ਜਾ ਰਿਹਾ ਸੀ ਕੁਛ ਪਿੰਡ ਅਤੇ ਕੋਈ ਸ਼ਹਿਰ ਇਹੋ ਜਿਹੇ ਸਨ ਜਿਨ੍ਹਾਂ ਵਿੱਚ ਸਕੂਲਾਂ ਦੀ ਕਮੀ ਸੀ ਬੱਚੇ ਦੂਰ ਪੜ੍ਹਨ ਨਹੀਂ ਜਾਂਦੇ ਸੀ ਸਰਕਾਰ ਨੇ ਉਹਨਾਂ ਦਾ ਵੀ ਇਸ ਤਰ੍ਹਾਂ ਹੱਲ ਕੀਤਾ ਕਿ ਹਰ ਪੰਜ ਕਿਲੋਮੀਟਰ ਦਾਇਰੇ ਦੇ ਅੰਦਰ ਇੱਕ ਇੱਕ ਸਕੂਲ ਖੋਲ੍ਹਿਆ ਤਾਂ ਕਿ ਸਾਰੇ ਬੱਚੇ ਜਾ ਕੇ ਪੜ੍ਹਾਈ ਕਰ ਸਕਣ ਸਾਰੇ ਬੱਚਿਆਂ ਨੂੰ ਪੜ੍ਹਾਈ ਦਾ ਮ ਫਾਇਦਾ ਮਿਲ ਸਕੇ ਇਸ ਤਰ੍ਹਾਂ ਸਾਰੇ ਬੱਚੇ ਸਕੂਲਾਂ 'ਚ ਜਾਣ ਲੱਗੇ ਪੜ੍ਹਾਈ ਦਾ ਮਾਧਿਅਮ ਉੱਪਰ ਆਉਣ ਲੱਗਿਆ ਪੜ੍ਹਾਈ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਲਈ ਸਰਕਾਰ ਨੇ ਸਕੂਲ ਖੋਲ੍ਹਣੇ ਸ਼ੁਰੂ ਕੀਤੇ ਉਸ ਤੋਂ ਬਾਅਦ ਜਿਵੇਂ ਦੇਖ ਸਕਦੇ ਹਾਂ ਕਿ ਕੁਛ ਨਹਿਰਾਂ ਸਨ ਜੋ ਨਹਿਰਾਂ ਕੱਚੀਆਂ ਸਨ ਅਤੇ ਉਸਦਾ ਜਦੋਂ ਮੀਂਹ ਪੈਂਦੇ ਸਨ ਉਹਨਾਂ ਦੇ ਪਾਣੀ ਪਿੰਡਾਂ ਦੇ ਵਿੱਚ ਆ ਜਾਂਦੇ ਸਨ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਸੀ ਫਸਲਾਂ ਦਾ ਨੁਕਸਾਨ ਹੋ ਜਾਂਦਾ ਸੀ ਸਰਕਾਰਾਂ ਨੇ ਇਸ ਨਜ਼ਰ ਨੂੰ ਰੱਖਦੇ ਹੋਏ ਗੱਲ ਨੂੰ ਕਿ ਨੁਕਸਾਨ ਹੋ ਰਿਹਾ ਹੈ ਸਰਕਾਰ ਨੇ ਸਭ ਤੋਂ ਪਹਿਲਾਂ ਸਾਰੀਆਂ ਨਹਿਰਾਂ ਪੱਕੀਆਂ ਕਰਵਾਈਆਂ ਜਿਸ ਦਾ ਇਹ ਫਾਇਦਾ ਹੋਇਆ ਕਿ ਜਦੋਂ ਬਾਰਿਸ਼ ਆਉਂਦੀ ਸੀ ਮੀਂਹ ਦਾ ਪਾਣੀ ਜਿੰਨਾਂ ਵੀ ਬਾਰਿਸ਼ ਦਾ ਹੋ ਜਾਵੇ ਉਹ ਪਿੰਡਾਂ ਦੇ ਵਿੱਚ ਨਹੀਂ ਜਾਂਦਾ ਸੀ ਕਿਉਂਕਿ ਨਹਿਰਾਂ ਪੱਕੀਆਂ ਹੋ ਗਈਆਂ ਉਹ ਟੁੱਟਣ ਦਾ ਖਤਰਾ ਘੱਟ ਗਿਆ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਸ਼ਹਿਰਾਂ ਦੇ ਵਿੱਚ ਸਭ ਪ ਪਹਿਲਾਂ ਕੂੜਾ ਕਰਕਟ ਬਹੁਤ ਰੋਡ ਦੇ ਉੱਪਰ ਹੁੰਦਾ ਸੀ ਫਿਰ ਸਰਕਾਰਾਂ ਨੇ ਅਲੱਗ ਤੋਂ ਵੱਡੇ ਡਸਟਬੀਨ ਲਗਵਾਏ ਕੂੜਾ ਪਾਉਣ ਵਾਲੇ ਜਿਹਨਾਂ ਵਿੱਚ ਕਿ ਸਾਰੇ ਆਪਣਾ ਆਪਣਾ ਕੂੜਾ ਸਿੱਟ ਕੇ ਜਾਂਦੇ ਸਨ ਉਹਦੇ ਨਾਲ ਕੀ ਹੋਇਆ ਸ਼ਹਿਰਾਂ ਦੇ ਵਿੱਚ ਜੋ ਗੰਦਗੀ ਸੀ ਉਹ ਘੱਟਦੀ ਗਈ ਅਤੇ ਬਿਮਾਰੀਆਂ ਘੱਟਦੀਆਂ ਗਈਆਂ ਇਸ ਦਾ ਇਹ ਫਾਇਦਾ ਹੋਇਆ ਉਸ ਤੋਂ ਬਾਅਦ ਸਰਕਾਰਾਂ ਨੇ ਪਲਿਊਸ਼ਨ ਨੂੰ ਕੰਟਰੋਲ ਕੀਤਾ ਪ੍ਰਦੂਸ਼ਣ ਜੋ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਹੋ ਰਿਹਾ ਏ ਸਰਕਾਰਾਂ ਨੇ ਗੱਡੀਆਂ ਇਹੋ ਜਿਹੀਆਂ ਬਣਵਾਈਆਂ ਜੋ ਪੈਟਰੋਲ ਡੀਜ਼ਲ 'ਤੇ ਨਹੀਂ ਚੱਲ ਰਹੀਆਂ ਚਾਰਜ ਹੋ ਰਹੀਆਂ ਹਨ ਉਹ ਇਹੋ ਜਿਹੀਆਂ ਕਾਰਾਂ ਹਨ ਕਿ ਉਹ ਪ੍ਰਦੂਸ਼ਣ ਬਹੁਤ ਘੱਟ ਕਰਦੀਆਂ ਹਨ ਵ ਜ਼ਹਿਰੀਲੀਆਂ ਗੈਸਾਂ ਨਹੀਂ ਛੱਡਦੀਆਂ ਉਹਨਾਂ ਦਾ ਸਾਡੇ ਵਾਤਾਵਰਨ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਪੰਛੀਆਂ ਨੂੰ ਫਾਇਦਾ ਹੋਇਆ ਜੋ ਕਿ ਪੰਛੀ ਦਿਨ ਬਰ ਦਿਨ ਮਰਦੇ ਜਾ ਰਹੇ ਸਨ ਇਸ ਤਰ੍ਹਾਂ ਸਰਕਾਰ ਨੂੰ ਅੱਗੇ ਤੋਂ ਅੱਗੇ ਹੋਰ ਵੀ ਬਹੁਤ ਚੁਣੌਤੀਆਂ ਆ ਰਹੀਆਂ ਹਨ ਪਰ ਸਰਕਾਰ ਸਮੇਂ ਦੇ ਅਨੁਸਾਰ ਉਹ ਚਣੌਤੀਆਂ ਨੂੰ ਹੱਲ ਕਰਦੀ ਜਾ ਰਹੀ ਹੈ ਅਤੇ ਮੈਨੂੰ ਉਮੀਦ ਹੈ ਅੱਗੇ ਵੀ ਕਰਦੀ ਜਾਊਂਗੀ ਸਰਕਾਰ